ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਉਦਯੋਗਾਂ ਦੇ ਸਾਧਨ ਹਨ ਇੱਥੇ ਬਹੁਤ ਸਾਰੀਆਂ ਇੰਡਸਟਰੀਆਂ ਹਨ ਇਸ ਦਾ ਕਾਰਨ ਆਵਾਜਾਈ ਦੇ ਸਾਧਨ ਹਨ ਇੱਥੇ ਆਵਾਜਾਈ ਦੇ ਬਹੁਤ ਸਾਰੇ ਸਾਧਨ ਮਿਲ ਜਾਂਦੇ ਹਨ ਇੱਥੇ ਦੀਆਂ ਸੜਕਾਂ ਬਹੁਤ ਵਧੀਆ ਹਨ ਜਿਸ ਕਾਰਨ ਆਵਾਜਾਈ ਬਹੁਤ ਵਧੀਆ ਤਰੀਕੇ ਨਾਲ ਚੱਲਦੀ ਹੈ ਇਸ ਉ ਇੱਥੋਂ ਇੱਥੋਂ ਚੀਜ਼ਾਂ ਦਾ ਆਦਾਨ ਪ੍ਰਦਾਨ ਵੀ ਆਸਾਨੀ ਨਾਲ਼ ਕੀਤਾ ਜਾਂਦਾ ਹੈ ਇੱਥੇ ਦੀਆਂ ਇੰਡਸਟਰੀਆਂ ਨੇ ਓ ਉੱਥੇ ਦੇ ਰਹਿਣ ਦੇ ਵਸਨੀਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਉਹਨਾਂ ਦੀ ਆਰਥਿਕ ਵਿਵਸਥਾ ਨੂੰ ਬਹੁਤ ਮਜ਼ਬੂਤ ਬਣਾਇਆ ਹੈ ਉਹਨਾਂ ਦੀ ਆਰਥਿਕ ਵਿਵਸਥਾ ਬਹੁਤ ਉੱਚੀ ਹੋ ਗਈ ਹੈ ਉਹਨਾਂ ਦਾ ਰਹਿਣ ਸਹਿਣ ਬਹੁਤ ਵਧੀਆ ਹੋ ਗਿਆ ਹੈ ਉਹਨਾਂ ਦੀ ਪ ਉਹਨਾਂ ਦੀ ਸਿੱਖਿਆ ਦਾ ਪੱਧਰ ਵੀ ਉੱਚਾ ਹੋ ਗਿਆ ਹੈ